ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਾਰ ਡੀਲਰ ਬੋਲਦੇ ਜੀ ਸਰ ਗੱਡੀ ਚਾਹੀਦੀ ਤੀ ਦਿੱਲੀ ਨੰਬਰ ਦਿੱਲੀ ਨੰਬਰ ਸਰ ਫੋਰਚੂਨਰ ਸਰ ਸਰ ਫੋਰਚੂਨਰ ਹੈ ਹੈਲੋ ਸਰ ਰਪੀਟ ਕਰਿਓ ਸਰ ਪ੍ਰਾਈਜ਼ ਰਪੀਟ ਕਰਿਓ ਸਰ ਟੈਰ ਸਰ ਸਰਵਿਸ ਵਗੈਰਾ ਸਹੀ ਹੋਈ ਉਹਦੀ ਸਰ ਏਅਰਪੋਰਟ 'ਤੇ ਜੀ ਨਹੀਂ ਨਹੀਂ ਸਰ ਇਹੀ ਕਰੋ ਸਰ ਇਹੀ ਫਾਈਨਲ ਕਰੋ ਸਰ ਡਿੱਗੀ ਉਹਦੀ ਵਰਕਿੰਗ ਹੈ ਜੀ ਸਰ ਐਡਰੈੱਸ ਕਿੱਥੇ ਹੈ ਅੱਛਾ ਜੀ ਠੀਕ ਹੈ ਸਰ ਫਿਰ ਮੈਂ ਉੱਥੇ ਆ ਕੇ ਗੱਲ ਕਰਦਾਂ ਓਕੇ ਸਰ ਧੰਨਵਾਦ ਜੀ